ਮੇਰੀ ਤਾਰਿਆਂ ਬਾਰੇ ਕਹਾਣੀ ਇਹ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੇ ਮੰਮੀ ਨੇ ਮੈਨੂੰ ਬਹੁਤ ਜ਼ਿਆਦਾ ਡਾਂਟਿਆ ਅਤੇ ਮੈਂ ਗੁੱਸੇ ਵਿੱਚ ਕਮਰੇ ਤੋਂ ਬਾਹਰ ਆ ਕੇ ਗਾਰਡਨ ਵਿੱਚ ਲੇਟ ਗਿਆ ਅਤੇ ਜਦੋਂ ਮੈਂ ਅੱਖਾਂ ਬੰਦ ਕਰਕੇ ਲੇਟਿਆ ਅੱਖਾਂ ਖੋਲ੍ਹੀਆਂ ਦੇ ਉੱਪਰ ਰਾਤ ਦਾ ਸਮਾਂ ਸੀ ਉੱਪਰ ਬਹੁਤ ਸਾਰੇ ਤਾਰੇ ਸੀ ਜਿਹਦੇ ਵਿੱਚ ਇੱਕ ਤਾਰਾ ਬਹੁਤ ਹੀ ਚਮਕ ਰਿਹਾ ਸੀ ਔਰ ਮੈਨੂੰ ਬੜਾ ਹੀ ਚੰਗਾ ਲੱਗ ਰਿਹਾ ਸੀ ਉਹਨੂੰ ਦੇਖ ਕੇ ਔਰ ਮੈਨੂੰ ਉਸ ਦਿਨ ਤੋਂ ਤਾਰੇ ਬਹੁਤ ਚੰਗੇ ਲੱਗਣੇ ਸ਼ੁਰੂ ਹੋ ਗਏ ਉਦੋਂ ਮੈਂ ਛੋਟਾ ਹੁੰਦਾ ਸੀ ਅਤੇ ਤਾਰੇ ਬਹੁਤ ਸੋਹਣੇ ਲੱਗਦੇ ਸੀ ਅਤੇ ਮੇਰਾ ਦਿਲ ਕਰਦਾ ਸੀ ਮੈਂ ਕਦੀ ਇੱਕ ਤਾਰੇ ਨੂੰ ਦੂਜੇ ਨੂੰ ਤੀਜੇ ਨੂੰ ਚੌਥੇ ਨੂੰ ਪੰਜ ਛੇ ਤਾਰੇ ਜੋੜ ਕੇ ਕੁਛ ਵੀ ਬਣਾ ਦਿੰਦਾ ਸੀ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਰੇ ਅਸਮਾਨ ਵਿੱਚ ਦੇਖੋ ਤਾਂ ਤੁਹਾਨੂੰ ਇੱਕ ਜਾਂ ਦੋ ਹੀ ਨਜ਼ਰ ਆਉਂਦੇ ਨੇ ਕਿਉਂਕਿ ਅੱਜ ਕੱਲ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ ਜਿਹਦੇ ਕਾਰਨ ਪੋਲਿਊਸ਼ਨ ਦੇ ਕਾਰਨ ਤਾਰੇ ਧੂੰਏਂ ਦੇ ਵਿੱਚ ਹੀ ਮਿਕਸ ਹੋ ਕੇ ਅਲੋਪ ਹੋ ਜਾਂਦੇ ਹਨ ਇਸ ਕਰਕੇ ਅੱਜ ਕੱਲ੍ਹ ਤਾਰੇ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਬਚਪਨ ਵਿੱਚ ਅਸੀਂ ਇਮੈਜਿਸਟ ਇਮੈਜੀਨੇਸ਼ਨ ਕਰਕੇ ਤਾਰਿਆਂ ਵਿੱਚ ਕਦੀ ਡਰਾਇੰਗ ਵਿੱਚ ਕਦੀ ਐਲੀਫੈਂਟ ਬਣਾ ਦੇਈਦਾ ਸੀ ਕਦੀ ਏ ਬੀ ਸੀ ਡੀ ਐਲਫਾਬੈਟ ਬਣਾਉਂਦੇ ਸੀ ਬੜਾ ਕੁਝ ਤਾਰਿਆਂ ਨਾਲ ਖੇਡਦੇ ਸੀ ਇਸ ਕਰਕੇ ਸਾਨੂੰ ਤਾਰੇ ਬੜੇ ਚੰਗੇ ਲੱਗਦੇ ਸਨ